ਭਾਅ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਬਾਈ ਠੀਕ ਹੋ ਬਹੁਤ ਵਧੀਆ ਭਾਅ ਜੀ ਬਹੁਤ ਵਧੀਆ ਅਤੇ ਭਾਅ ਜੀ ਆਪਣੇ ਫਰੂਟਸ ਦੀ ਕੀ ਵਰੈਇਟੀ ਆਈ ਹੈ ਹੁਣ ਨਵੀਂ ਨਵੀਂ ਠੀਕ ਹੈ ਠੀਕ ਹੈ ਠੀਕ ਹੈ ਭਾਅ ਜੀ ਠੀਕ ਹੈ ਜੀ ਅਤੇ ਇਹ ਜਿਹੜੇ ਭਾਅ ਜੀ ਆਗੇ ਆਲੇ ਮਤਲਵ ਇਹਨਾਂ ਦਾ ਮੌਸਮ ਆਇਆ ਨਹੀਂ ਹੈਗਾ ਫਰੂਟਸ ਦਾ ਅਤੇ ਜਿਹੜੇ ਐਂਬੋ ਉਹ ਮੈਗੋ ਵਗੈਰਾ ਹੋ ਗਏ ਇਹ ਖਾਣ ਨੂੰ ਠੀਕ ਹੋਣਗੇ ਨਾ ਇਹ ਕੋਈ ਦਿੱਕਤ ਤਾਂ ਨਹੀਂ ਹੋਣੀ ਇਹਨਾਂ 'ਚ ਠੀਕ ਹੈ ਠੀਕ ਹੈ ਠੀਕ ਹੈ ਭਾਅ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਅਸੀਂ ਵੀ ਭਾਅ ਜੀ ਨਵੇਂ ਸ਼ਿਫਟ ਹੋਏ ਸੀ ਨਾ ਮੈਨੂੰ ਮੇਰੇ ਦੋਸਤ ਨੇ ਦੱਸਿਆ ਸੀ ਵੀ ਫਰੂਟ ਵਗੈਰਾ ਮੰਗਵਾਉਣਾ ਇਕੱਠਾ ਹੀ ਤੁਹਾਡੇ ਕੋਲੋਂ ਮੰਗਵਾਓ ਮੈਂ ਤਾਂ ਆਹ ਗੱਲ ਕਰ ਰਿਹਾ ਸੀ ਬੱਸ ਭਾਅ ਜੀ ਬਹੁਤ ਬਹੁਤ ਧੰਨਵਾਦ ਅਤੇ ਉਹ ਦੱਸੋ ਮੈਨੂੰ ਡਰੈਗਨ ਫਰੂਟ ਮਿਲਜੂ ਆਪਣੇ ਕੀ ਕੀ ਰੇਟ ਚੱਲਦਾ ਉਹਦਾ ਮੈਂ ਕਰੇਟਸ ਬਣਾਉਣੇ ਸੀ ਤੁਹਾਡੇ ਤੋਂ ਦਸ ਇੱਕ ਹਜ਼ਾਰ ਦਾ ਠੀਕ ਹੈ ਠੀਕ ਹੈ ਵੀਹ ਪੰਜ ਕਰੇਟ ਚੜਾਉਣੇ ਭਾਅ ਜੀ ਆਪਾ ਅਤੇ ਇੱਕ ਭਾਅ ਜੀ ਅੰਬ ਮੇਰੇ ਨਾ ਦੋਸਤ ਦੇ ਜਨਮਦਿਨ ਦੀ ਪਾਰਟੀ ਆ ਉਹਦੇ ਵਾਸਤੇ ਵੱਡਾ ਹੀ ਈਵੈਂਟ ਕਰਾ ਰਹੇ ਹੈ ਉਹ ਅਤੇ ਕਰੇਟ ਇਹਦੇ ਦੋ ਚੜਾ ਦਿਓ ਭਾਅ ਜੀ ਠੀਕ ਹੈ ਠੀਕ ਹੈ ਹਰੇਕ ਹਰੇਕ ਇੱਕ ਕਰੇਟ 'ਚ ਵੀਹ ਪੀਸ ਹੀ ਹੁੰਦੇ ਇਹਦਾ ਮਤਲਵ ਜਿਹੜਾ ਮਰਜ਼ੀ ਲੈ ਲਓ ਵਧੀਆ ਕੁਆਲਟੀ ਵਾਲਾ ਕਿਹੜਾ ਭਾਅ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਬਸ ਠੀਕ ਹੈ ਠੀਕ ਹੈ ਠੀਕ ਹੈ ਭਾਅ ਜੀ ਚਲੋ ਮੈਨੂੰ ਐ ਘਰ ਹੋ ਤੁਸੀਂ ਇੱਥੇ ਨਾਭੇ ਰੋਡ 'ਤੇ ਨਾ ਆਪਣੇ ਪੈਲਸ ਆ ਸਪਰਿੰਗ ਫ਼ੀਲਜ਼ ਅਤੇ ਓ ਉੱਥੇ ਪਹੁੰਚਾਉਣੇ ਹੈ ਸਾਰੇ ਇਹ ਅਤੇ ਤਰੀਕ ਆਪਣੀ ਰੱਖੀ ਹੋਈ ਹੈ ਜੀ ਅਗਲੇ ਮਹੀਨੇ ਦੀ ਦਸ ਬਸ ਠੀਕ ਹੈ ਠੀਕ ਹੈ ਭਾਅ ਜੀ ਅਤੇ ਕੋਈ ਡਿਲੀਵਰੀ ਚਾਰਜਿਸ ਵਗੈਰਾ ਤਾਂ ਨਹੀਂ ਹੈਗੇ ਮੈਂ ਤੁਹਨੂੰ ਐਡਵਾਂਸ ਵਗੈਰਾ ਕਿੱਥੋਂ ਤੁਹਾਡੀ ਦੁਕਾਨ 'ਤੇ ਹੀ ਫੜਾ ਜੂੰਗਾ ਕੋਈ ਦਿੱਕਤ ਨਹੀਂ ਚਲੋ ਠੀਕ ਹੈ ਭਾਅ ਜੀ ਬਹੁਤ ਬਹੁਤ ਧੰਨਵਾਦ ਤੁਹਡਾ ਓਕੇ